ਸਾਡੇ ਖੇਤਰ ਦੇ ਸਟੇਡੀਅਮ ਔਰ ਨਾਸ ਗਰਾਉਂਡਾਂ ਅਤੇ ਖੇਡਾਂ ਸਮਾਗਮ ਕਰਵਾਉਣ ਲਈ ਬਹੁਤ ਹੀ ਸਹੂਲਤਾਂ ਉਪਲਬਧ ਵਾ ਜਿੱਦਾਂ ਬੱਚਿਆਂ ਦੇ ਸਾਈਕਲ ਚਲਾਉਣ ਲਈ ਸਾਈਕਲਿੰਗ ਕਰਨ ਵਾਸਤੇ ਸਟੇਡੀਅਮ ਬਣਾਏ ਗਏ ਬੱਚਿਆ ਦੇ ਭੱਜਣ ਵਾਸਤੇ ਸਟੇਡੀਅਮ ਬਣਾਏ ਗਏ ਆ ਜਿਵੇਂ ਹੁਣ ਬੱਚੇ ਅੱਜ ਲੌਂਗ ਜੰਪ ਕਰਦੇ ਹਾਈ ਜੰਪ ਕਰਦੇ ਆ ਉਹਨਾਂ ਵਾਸਤੇ ਸਟੇਡੀਅਮ ਬਣਾਏ ਗਏ ਆ ਜਿਹੜੇ ਬੱਚੇ ਕਬੱਡੀ ਕਰਦੇ ਆ ਉਹਨਾਂ ਵਾਸਤੇ ਕਬੱਡੀ ਲਈ ਵੱਖਰੀ ਜਗ੍ਹਾ ਇੱਕ ਬਣਾਈ ਗਈ ਆ ਉਹਦੇ ਵਿੱਚ ਬੱਚੇ ਕਬੱਡੀ ਖੇਡਦੇ ਆ ਅਤੇ ਇੱਕ ਜਿਵੇਂ ਆਪਾਂ ਅੱਜ ਕੱਲ੍ਹ ਬੱਚੇ ਨਸ਼ਿਆਂ ਵਿੱਚ ਬੜਾ ਪੈ ਗਏ ਆ ਉਹ ਤੋਂ ਦੂਰ ਰਹਿੰਦੇ ਆ ਇਹ ਚੀਜ਼ ਸਾਨੂੰ ਬੜੀ ਵਧੀਆ ਲੱਗਦੀ ਆ ਕਿ ਜਿਵੇਂ ਅੱਜ ਕੱਲ੍ਹ ਬੱਚੇ ਜਿੰਮ ਕਰਦੇ ਆ ਅਤੇ ਜਿੰਮ ਕਰਨ ਦੇ ਨਾਲ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਆ ਸਾਰੇ ਮਾਂ ਪਿਓ ਨੂੰ ਇਹ ਖੁਸ਼ੀ ਹੁੰਦੀ ਕਿ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਪੰਜਾਬ ਵਿੱਚ ਇਹ ਬਹੁਤ ਜ਼ਿਆਦਾ ਨਸ਼ਿਆਂ ਦਾ ਜ਼ੋਰ ਚੱਲ ਚੁੱਕਾ ਵਾ ਜਿਹਦੇ ਨਾਲ ਬੱਚਿਆਂ ਦੀ ਜ਼ਿੰਦਗੀ ਬੜੀ ਖਰਾਬ ਹੋਣ ਦਈ ਆ ਇੱਕ ਬੱਚੇ ਬਾਹਰ ਤੁਰੇ ਫਿਰਦੇ ਆ ਬਾਹਰ ਜਾਂਦੇ ਆ ਨਾਲੇ ਉਹ ਆਪਣੇ ਪਰਿਵਾਰ 'ਚ ਰਹਿੰਦੇ ਆ ਆਪਣੇ ਕਲਚਰ ਦੇ ਨਾਲ ਰਹਿੰਦੇ ਜੁੜ ਕੇ ਜੇ ਉਹ ਬਾਹਰ ਨਾ ਜਾਣਗੇ ਤਾਂ ਇੱਥੇ ਗੇਮਾਂ ਕਰਦੇ ਆ ਖੇਡਦੇ ਆ ਅਤੇ ਉਹਨਾਂ ਨੂੰ ਬਹੁਤ ਵੱਧ ਤੋਂ ਵੱਧ ਸੂਲਤਾਂ ਦਿੱਤੀਆਂ ਜਾਣ